ਹਾਂਜੀ ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਆ ਜ਼ਿਆਦਾਤਰ ਕਈ ਇਹੋ ਜਿਹੀਆਂ ਸਮੱਗਰੀਆਂ ਆ ਕਿ ਜਿਹੜੇ ਮੈਂ ਖਾਣੇ ਦੇ ਵਿੱਚ ਖੁਸ਼ਬੂ ਵਾਸਤੇ ਪਾਉਂਦੀ ਹਾਂ ਅਤੇ ਖਾਣੇ ਦਾ ਸਵਾਦ ਵੀ ਵੱਧ ਜਾਂਦਾ ਹੈ ਅਤੇ ਖਾਣੇ ਨੂੰ ਖੁਸ਼ਬੂਦਾਰ ਵੀ ਬਣਾਉਂਦੀਆਂ ਨੇ ਜਿਵੇਂ ਕਿ ਤੁਸੀਂ ਜੀਰਾ ਲੈ ਲਉ ਜੀਰਾ ਆਪਾਂ ਤੜਕਾ ਲਗਾਉਂਦੇ ਸਮੇਂ ਜੀਰਾ ਪਾਉਂਦੇ ਹਾਂ ਅਤੇ ਇਹਦੀ ਸਮੈਲ ਬਹੁਤ ਵਧੀਆ ਹੁੰਦੀ ਆ ਅਤੇ ਇਹਦੇ ਨਾਲ ਬਹੁਤ ਟੇਸਟੀ ਖਾਣਾ ਬਣਦਾ ਹੈ ਔਰ ਜਿਵੇਂ ਕਿ ਕਸਤੂਰੀ ਮੇਥੀ ਕਸਤੂਰੀ ਮੇਥੀ ਆਪਾਂ ਸੁਕਾ ਕੇ ਘਰ ਅਤੇ ਉਹਨੂੰ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਹਾਂ ਅਤੇ ਬਹੁਤ ਵਧੀਆ ਸਬਜ਼ੀ 'ਚੋਂ ਸਮੈਲ ਆਉਂਦੀ ਹੈ ਅਤੇ ਬਹੁਤ ਸਬਜ਼ੀ ਸਵਾਦ ਬਣਦੀ ਹੈ ਔਰ ਸਰਦੀਆਂ ਦੇ ਟਾਈਮ 'ਚ ਅਸੀਂ ਧਨੀਆਂ ਪਾਉਂਦੇ ਹਾਂ ਸਬਜ਼ੀ ਵਿੱਚ ਇਹਨੂੰ ਅਸੀਂ ਕੱਟ ਕੇ ਪਾਉਂਦੇ ਹਾਂ ਔਰ ਸਬਜ਼ੀ ਦੇ ਵਿੱਚ ਬਹੁਤ ਵਧੀਆ ਹਰਿਆਲੀ ਔਰ ਬਹੁਤ ਸਵਾਦ ਔਰ ਸਮੈਲ ਇਹਦੇ ਨਾਲ ਦੁੱਗਣੀ ਹੋ ਜਾਂਦੀ ਹੈ ਔਰ ਕਈ ਵਾਰ ਅਸੀਂ ਹਿੰਗ ਪਾਉਂਦੇ ਹਾਂ ਹਿੰਗ ਸਾਨੂੰ ਬਾਜ਼ਾਰੋਂ ਮਿਲਦੀ ਹੈ ਅਤੇ ਇਸ ਦੇ ਨਾਲ ਸਬਜ਼ੀ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਔਰ ਕਈ ਵਾਰ ਅਸੀਂ ਗੁਲਾਬ ਦੀਆਂ ਪੱਤੀਆਂ ਵੀ ਸੁਕਾ ਕੇ ਔਰ ਪੀਸ ਕੇ ਉਹਦਾ ਪਾਊਡਰ ਬਣਾ ਕੇ ਉਹ ਸਬਜ਼ੀ ਦੇ ਵਿੱਚ ਪਾਉਂਦੇ ਹਾਂ ਇਸ ਦੇ ਨਾਲ ਵੀ ਸਾਡੀ ਸਬਜ਼ੀ ਦੀ ਸਮੈਲ ਬਹੁਤ ਵਧੀਆ ਆਉਂਦੀ ਹੈ ਔਰ ਕਈ ਕਈ ਵਾਰ ਅਸੀਂ ਗਰਮ ਮਸਾਲਾ ਪਾਉਂਦੇ ਹਾਂ ਜਿਵੇਂ ਕਿ ਗਰਮ ਮਸਾਲਾ ਅਸੀਂ ਘਰ ਤਿਆਰ ਕਰਦੇ ਹਾਂ ਗਰਮ ਮਸਾਲਾ ਅਸੀਂ ਖੁਦ ਪੀਸਦੇ ਹਾਂ ਔਰ ਹਰ ਕੋਈ ਇਹ ਚੀਜ਼ਾਂ ਨਹੀਂ ਪਾਉਂਦਾ ਮੈਂ ਪਾਉਂਦੀ ਹਾਂ ਕਿਉਂਕਿ ਮੈਨੂੰ ਬਹੁਤ ਪਸੰਦ ਆ ਗਰਮ ਮਸਾਲਾ ਔਰ ਕਈ ਵਾਰ ਅਸੀਂ ਕੜੀ ਪੱਤਾ ਵੀ ਪਾਉਂਦੇ ਹਾਂ ਕੜੀ ਪੱਤਾ ਬਹੁਤ ਵਧੀਆ ਸਬਜ਼ੀ ਨੂੰ ਖੁਸ਼ਬੂਦਾਰ ਔਰ ਸਵਾਦਿਸ਼ਟ ਬਣਾਉਂਦਾ ਹੈ